ਮੈਂ ਆਪਣੀ ਗਾਇਕੀ ਦਾ ਅਭਿਆਸ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕਰਦਾ ਹਾਂ ਜਿਸ ਵਿੱਚ ਮੈਨੂੰ ਦੋਸਤਾਂ ਦਾ ਕਾਫੀ ਸਹਿਯੋਗ ਮਿਲਦਾ ਹੈ ਅਤੇ ਜਿਸ ਕਿਸੇ ਜਗ੍ਹਾ 'ਤੇ ਮੈਨੂੰ ਸੰਗੀਤ ਵਿੱਚ ਕੋਈ ਮੁਸ਼ਕਿਲ ਲੱਗਦੀ ਹੈ ਰਾਗ ਜਾਂ ਹੋਰ ਕੋਈ ਚੀਜ਼ ਸਮਝਣ ਵਿੱਚ ਉਹ ਮੈਨੂੰ ਸਮਝਾਉਂਦੇ ਨੇ ਅਤੇ ਮੈਨੂੰ ਗਾਇਕੀ ਦੇ ਗੁਰ ਬਾਰੇ ਠੀਕ ਤਰ੍ਹਾਂ ਦੱਸਦੇ ਨੇ ਜਿਸ ਦੇ ਨਾਲ ਮੇਰੀ ਗਾਇਕੀ ਵਿੱਚ ਕਾਫੀ ਸੁਧਾਰ ਆ ਰਿਹਾ ਹੈ ਅਤੇ ਮੈਂ ਕਿਸੇ ਸ਼ਾਂਤ ਜਗ੍ਹਾ 'ਤੇ ਬੈਠ ਕੇ ਇਕੱਲਾ ਵੀ ਕਾਫੀ ਅਭਿਆਸ ਕਰਦਾ ਰਹਿੰਦਾ ਹਾਂ ਤਾਂ ਕਿ ਮੈਂ ਇੱਕ ਚੰਗਾ ਗਾਇਕ ਬਣ ਜਾਵਾਂ ਇਸ ਤਰ੍ਹਾਂ ਜਦ ਪਾਰਕ ਵਿੱਚ ਬੈਠਿਆਂ ਕਿਤੇ ਲ ਆਸ ਪਾਸ ਸ਼ੋਰ ਸ਼ਰਾਬਾ ਜਾਂ ਮ ਮਿਊਜ਼ਿਕ ਲੋਡ ਮਿਊਜਿਕ ਚੱਲਦਾ ਹੈ ਉਸ ਵੇਲੇ ਕੁਝ ਪਰੇਸ਼ਾਨੀ ਵੀ ਆਉਂਦੀ ਹੈ ਇਸ ਲਈ ਸ਼ਾਂਤ ਜਗ੍ਹਾ ਜ਼ਰੂਰੀ ਹੈ ਜਿਸ ਵਿੱਚ ਜੈਸੇ ਘਰ ਵਿੱਚ ਇਕੱਲਿਆਂ ਇਕੱਲੇ ਰੂਮ ਵਿੱਚ ਬੈਠ ਕੇ ਜਾਂ ਕਿਸੇ ਪਾਰਕ ਦੇ ਵਿੱਚ ਸ਼ਾਮ ਜਾਂ ਸਵੇਰ ਵੇਲੇ ਟਾਈਮ ਮਿਲ ਜਾਂਦਾ ਜਿਸ ਦੇ ਵਿੱਚ ਅਭਿਆਸ ਕਰਨ ਦਾ ਚੰਗਾ ਮੌਕਾ ਮਿਲ ਜਾਂਦਾ ਹੈ ਅਤੇ ਅਭਿਆਸ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ